ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀ ਕਈ ਪਲੱਸ ਵੰਨ ਵਿੱਚ ਜਾਣਾ ਪਸੰਦ ਕਰਦੇ ਹਨ ਪਲੱਸ ਵੰਨ ਦੇ ਵਿੱਚ ਉਹ ਆਰਟਸ ਮੈਡੀਕਲ ਨੋਨ ਮੈਡੀਕਲ ਅਤੇ ਹੋਰ ਕੋਈ ਸਟਰੀਮਸ ਚੂ ਚੂਸ ਕਰ ਲੈਂਦੇ ਹਨ ਪਰ ਕਈ ਐਸੇ ਵਿਦਿਆਰਥੀ ਹੁੰਦੇ ਹਨ ਜੋ ਆਈ ਟੀ ਆਈ ਕਰਦੇ ਹਨ ਜਿਹਦੇ ਵਿੱਚ ਉਹਨਾਂ ਨੂੰ ਪ੍ਰੈਕਟੀਕਲੀ ਸਕਿੱਲਸ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਆਈ ਟੀ ਆਈ ਕਰਨ ਦੇ ਨਾਲ ਜੋਬ ਪੋਸੀਬਿਲਿਟੀਜ਼ ਵੀ ਵੱਧ ਜਾਂਦੇ ਹਨ ਜੋ ਕਿ ਬਹੁਤ ਹੀ ਵਧੀਆ ਹੈ ਮੈਂ ਪਰ ਮੈਂ ਟੈਂਨਥ ਦਸਵੀਂ ਤੋਂ ਬਾਅਦ ਆਰਟਸ ਲੀਤੀ ਸੀ ਅਤੇ ਆਰਟਸ ਦੇ ਵਿੱਚ ਵੀ ਕਾਫੀ ਵਧੀਆ ਅਤੇ ਵਧੀਆ ਸਟਰੀਮਸ ਹੋਣ ਕਰਕੇ ਇਹਦੇ ਵਿੱਚ ਕਾਫੀ ਕਿਤਾਬਾਂ ਬੁੱਕਸ ਆਦਿ ਹੁੰਦੀਆਂ ਹਨ ਅਤੇ ਬਹੁਤ ਹੀ ਵਧੀਆ ਸਿੱਖਿਆ ਹੁੰਦੀ ਹੈ ਕਾਫੀ ਲੋਕ ਪਲੱਸ ਵੰਨ ਤੋਂ ਬਾਅਦ ਬਾਰਵੀਂ ਕਰਦੇ ਹਨ ਅਤੇ ਪਰ ਦਸਵੀਂ ਤੋਂ ਬਾਅਦ ਜ਼ਿਆਦਾਤਰ ਲੋਕ ਆਈ ਟੀ ਆਈ ਵਗੈਰਾ ਵੀ ਚੂਸ ਕਰਨ ਜੋ ਕਿ ਬਹੁਤ ਹੀ ਵਧੀਆ ਹੈ ਕਈ ਵਿਦਿਆਰਥੀ ਹੁੰਦੇ ਹਨ ਜੋ ਕੰਪਿਊਟਰ ਕੋਰਸ ਕਰਦੇ ਹਨ ਕੰਪਿਊਟਰ ਕੋਰਸ ਦੇ ਵਿੱਚ ਤੁਹਾਨੂੰ ਪ੍ਰੈਕਟੀਕਲੀ ਸਕਿੱਲਸ ਵੀ ਦਿੰਦੇ ਹਨ ਅਤੇ ਕਾਊਟਿੰਗ ਵਗੈਰਾ ਆਦਿ ਲਈ ਵੀ ਕੰਮ ਕਰਵਾਇਆ ਜਾਂਦਾ ਹੈ ਅਤੇ ਪਰ ਕਾਫੀ ਜ਼ਿਆਦਾਤਰ ਵਿਦਿਆਰਥੀ ਦਸਵੀਂ ਤੋਂ ਬਾਅਦ ਗਿਆਰਵੀਂ ਬਾਰਵੀਂ ਹੀ ਕਰਦੇ ਹਨ ਅਤੇ ਕਾਫੀ ਕਈ ਜਣੇ ਆਈ ਟੀ ਆਈ ਕਰਦੇ ਹਨ ਪਰ ਜੋ ਕਿ ਸਿੱਖਿਆ ਲਈ ਬਹੁਤ ਹੀ ਵਧੀਆ ਹੁੰਦੇ ਹਨ